ਧਾਰਮਿਕ ਖੇਤਰਾਂ ਦੇ ਬਾਹਰ ਛੋਟੇ ਛੋਟੇ ਕਾਰੋਬਾਰ ਜਿਵੇਂ ਕਿ ਪੱਗਾਂ ਰੁਮਾਲੇ ਸਾਹਿਬ ਕੜ੍ਹੇ ਕਿਰਪਾਨਾਂ ਅਤੇ ਕੜਾਹ ਪ੍ਰਸ਼ਾਦ ਹੋਰ ਵੀ ਕਈ ਤਰ੍ਹਾਂ ਦੇ ਕੱਪੜੇ ਜਿਵੇਂ ਕਿ ਸਰਬ ਲੋਹ ਭਾਂਡੇ ਗਾਤਰਾ ਕਿਰਪਾਨ ਆਦਿ ਹੋਰ ਕੱਪੜੇ ਜੋ ਕਿ ਗੁਰੂ ਘਰ ਵਿੱਚ ਧਾਰਮਿਕ ਸਥਾਨਾਂ ਵਿੱਚ ਵਿਛਾਏ ਜਾਂਦੇ ਹਨ